ਸਥਾਨਕ ਪੰਜਾਬ ਦੇ ਵਿੱਚ ਸਥਾਨਕ ਤੇ ਸਥਾਨਕ ਕਲਾਵਾਂ ਉਹ ਅਧਿਕਾਰੀਗਰਾ ਦੇ ਲਈ ਮਤਲਬ ਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਹੋ ਗਈ ਤੇ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਇਹ ਬਹੁਤ ਸਾਰੀਆਂ ਕਿਆ ਹ ਜਿਹੜੀਆਂ ਮਤਲਬ ਯੋਜਨਾਵਾਂ ਲੈ ਕੇ ਆ ਰਹੀ ਹੈ ਜਿੱਦਾਂ ਕਿ ਹੁਣ ਅਸੀਂ ਮਤਲਬ ਸੈਂਟਰ ਦੇ ਲੈਵਲ ਤੇ ਅਸੀਂ ਦੇਖ ਲਈਏ ਜਿੱਦਾਂ ਕਿ ਹੁਣ ਪੀ ਐਮ ਮੁਦਰਾ ਸਕੀਮ ਹੋ ਗਈ ਹ ਉਹਦੇ ਅਕੋਰਡਿੰਗ ਕਿਆ ਏ ਲੋਕਾਂ ਨੂੰ ਮਤਲਬ ਜਿਹੜੇ ਕਿ ਛੋਟੇ ਲੈਵਲ ਤੋਂ ਜਿਹੜੇ ਆਪਣਾ ਉਦਿੋਗ ਆ ਜੋ ਸਟਾਰਟ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਲੋਨ ਦਿੱਤਾ ਜਾਂਦਾ ਜਿਹੜਾ ਇਹ ਲੋਨ ਹੁੰਦਾ ਇਹ ਘੱਟ ਵਿਆਜ ਦੇ ਉੱਤੇ ਹੁੰਦਾ ਹ ਇਸ ਤਰਾਂ ਕਿ ਇਹ ਜਿਹੜੇ ਕਾਰੀਗਰ ਹ ਮਤਲਬ ਇਹਨਾਂ ਨੂੰ ਕਿਆ ਏ ਆਪਣਾ ਮਤਲਬ ਛੋਟੇ ਲੈਵਲ ਤੋਂ ਮਤਲਬ ਸਟਾਰਟ ਕਰਨ ਦੇ ਲਈ ਬਿਜਨਸ ਉਹਨਾਂ ਨੂੰ ਹੈਲਪ ਮਿਲਦੀ ਹ ਤੇ ਉਹ ਕਿਹਾ ਬਿਜਨਸ ਸਟਾਰਟ ਕਰ ਪਾਉਦੇ ਹਨ ਇਸੇ ਤਰ੍ਹਾਂ ਕਿਆ ਹ ਮਤਲਬ ਪੰਜਾਬ ਦੇ ਵਿੱਚ ਵੀ ਅਜਿਹੀਆਂ ਜਿਹੜੀਆਂ ਹੈਗੀਆਂ ਮਤਲਬ ਸਕੀਮਾਂ ਏ ਉਹ ਬਹੁਤ ਸਾਰੀਆਂ ਚੱਲ ਰਹੀਆਂ ਹਨ ਤੇ ਬਹੁਤ ਸਮੇਂ ਤੋਂ ਚੱਲ ਵੀ ਰਹੀਆਂ ਥੀਆਂ ਪਹਿਲਾਂ ਵੀ ਚੱਲ ਰਹੀਆਂ ਤੇ ਤੇ ਹੁਣ ਵੀ ਨਵੀਆਂ ਨਵੀਆਂ ਸਕੀਮਾਂ ਜਿਹੜੀਆਂ ਹਰ ਇੱਕ ਸਰਕਾਰ ਜਿੱਦਾਂ ਕਿ ਨਵੀਂ ਆਉਂਦੀ ਹ ਉਹ ਹਰ ਇੱਕ ਸਰਕਾਰ ਜਿਹੜੀ ਹੈਗੀ ਹ ਅਜਿਹੀਆਂ ਸਕੀਮਾਂ ਲੈ ਕੇ ਆਉਂਦੀ ਰਹਿੰਦੀ ਹੈ ਅਜਿਹੀਆਂ ਸਕੀਮਾਂ ਦੇ ਨਾਲ ਮਤਲਬ ਜਿਹੜੇ ਕਿ ਲੋਕ ਐ ਉਹ ਛੋਟੇ ਲੈਵਲ ਤੋਂ ਮਤਲਬ ਆਪਣਾ ਮਤਲਬ ਜੋ ਵੀ ਕੰਮ ਹ ਉਹ ਸਟਾਰਟ ਕਰਨਾ ਚਾਹੁੰਦੇ ਹੋ ਜਿੱਦਾਂ ਕਿ ਕੋਈ ਵੀ ਕਲਾ ਵਾਲਾ ਵਿਅਕਤੀ ਹੋ ਗਿਆ ਕੋਈ ਵੀ ਕਾਰੀਗਰ ਹੋ ਗਿਆ ਜਿਹਦਾ ਕਿ ਮਿੱਟੀ ਬਣਾਣ ਵਾਲੇ ਕਾਰੀਗਰ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰ ਹੋਗੇ ਹੋਰ ਬਰਤਨ ਬਣਾਉਣ ਵਾਲੇ ਹੋ ਗਏ ਹੋਰ ਵੀ ਕਾਫੀ ਦਿਨਾਂ ਦੇ ਜਿਹੜੇ ਕਾਰੀਗਰ ਹੋ ਗਏ ਉਹ ਆਪਣਾ ਕੰਮ ਜਿਹੜੇ ਹੈਗੇ ਆ ਉਹ ਛੋਟੇ ਲੈਵਲ ਤੋਂ ਸਟਾਰਟ ਕਰਨਾ ਚਾਹੁੰਦੇ ਆ ਉਹਦੇ ਲਈ ਕਿਆ ਹ ਜਿਹੜੇ ਉਹ ਹ ਮਤਲਬ ਉਹਨਾਂ ਨੂੰ ਹੈਲਪ ਮਿਲਦੀ ਉਹਾਂ ਨੂੰ ਲੋਨ ਦਿੱਤਾ ਜਾਂਦਾ ਤੇ ਲੋਨ ਤੋਂ ਜਿਹੜੇ ਹੈਗੇ ਆਪਣਾ ਕੰਮ ਸਟਾਰਟ ਕਰਦੇ ਉਹਨਾਂ ਨੂੰ ਜਿਹੜਾ ਲੋਨ ਹ ਉਹ ਕੱਟਦਾ ਤੇ ਦਿੱਤਾ ਜਾਂਦਾ ਇਸ ਲਈ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਦੱਸੀ ਚੁੱਕੀ ਆਂ ਪੀ ਐਮ ਮੁਦਰਾ ਜਿਹਦੇ ਨਾਲ ਬਹੁਤ ਸਾਰੀ ਉਹਨਾਂ ਦੀ ਹੈਲਪ ਹੁੰਦੀ ਹ ਇਸ ਤਰ੍ਹਾਂ ਮਤਲਬ ਕਿਆ ਹ ਉਹ ਸਟਾਰਟ ਕਰ ਪਾਉਂਦੇ ਨੇ